ਪਹਿਲੇ ਸਮਿਆਂ ਵਿੱਚ ਸਾਡੇ ਕਿਤੇ ਕੁਪੋਸ਼ਣ ਦੀ ਸਮੱਸਿਆ ਸੀ ਪਰ ਹੁਣ ਇਹ ਸਮੱਸਿਆ ਨਹੀਂ ਹੈ ਅਤੇ ਪਾਣੀ ਅਤੇ ਚੰਗੀ ਭੋ ਤੋਂ ਚੰਗਾ ਭੋਜਨ ਮਿਲਦਾ ਹੈ ਇਸ ਨੂੰ ਅਸੀਂ ਆਰਾਮ ਨਾਲ਼ ਹੱਲ ਕਰ ਚੁੱਕੇ ਹਾਂ